ਡਾਂਸ ਨੂੰ ਅਸੀਂ ਯਾਦਗਾਰੀ ਪ੍ਰਭਾਵਸ਼ਾਲੀ ਦੋਵੇਂ ਹੀ ਬਣਾ ਸਕਦੇ ਹਾਂ ਯਾਦਗਾਰੀ ਅਸੀਂ ਇਸ ਤਰ੍ਹਾਂ ਬਣਾ ਸਕਦੇ ਹਾਂ ਜਦੋਂ ਅਸੀਂ ਯ ਦੋਸਤਾਂ ਨਾਲ ਰਿਹਰਸਲ ਦੌਰਾਨ ਕੋਈ ਵੀ ਤਾਲਮੇਲ ਕਰਦੇ ਹਾਂ ਤਾਂ ਉਸ ਤਰ੍ਹਾਂ ਫੋਟੋਜ ਵੀਡੀਓਜ ਬਣਾਉਂਦੇ ਹਾਂ ਤਾਂ ਇਸ ਤਰ੍ਹਾਂ ਆਪਣਾ ਇੱਕ ਯਾਦਗਾਰੀ ਪਲ ਕੈਪਚਰ ਹੋ ਜਾਂਦਾ ਹੈ ਜਾਂ ਆਪਣੇ ਫੋਨ ਵਿੱਚ ਜਮ੍ਹਾਂ ਰਹਿ ਜਾਂਦਾ ਹੈ ਪ੍ਰਭਾਵਸ਼ਾਲੀ ਅਸੀਂ ਇਸ ਤਰ੍ਹਾਂ ਬਣਾ ਸਕਦੇ ਹਾਂ ਡਾਂਸ ਨੂੰ ਕੱਪੜਿਆਂ ਰਾਹੀਂ ਬਣਾ ਸਕਦੇ ਹਾਂ ਬੋਲੀਆਂ ਰਾਹੀਂ ਬਣਾ ਸਕਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਿੱਧਿਆਂ ਵਿੱਚ ਬੋਲੀਆਂ ਇੱਕ ਮੇਨ ਪਾਰਟ ਅਦਾ ਕਰਦੀਆਂ ਹਨ ਜਿਹੜੀਆਂ ਕੀ ਆ ਬੋਲੀਆਂ ਗਾਈਆਂ ਜਾਂਦੀਆਂ ਹਨ ਤਾੜੀਆਂ ਦੀ ਸਹਾਇਤਾ ਨਾਲ ਇਸ ਤਰ੍ਹਾਂ ਅਸੀਂ ਚੰਗਾ ਪ੍ਰਦਰਸ਼ਨ ਕਰਕੇ ਉਸਨੂੰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਣਾ ਸਕਦੇ ਹਾਂ